ਹੈਲੋ ਨਮਸਕਾਰ ਜੀ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਸਾਡੇ ਇੱਥੇ ਮੱਕੀ ਪੂਰੀ ਤਰ੍ਹਾਂ ਦੀ ਸਹੂਲਤਾਂ ਬੜੀਆਂ ਪਠਾ ਪੰਜਾਬ ਦੇ ਵਿੱਚ ਪਠਾਨਕੋਟ 'ਚ ਮੇਨ ਕਰਕੇ ਬੜੀਆਂ ਸਹੂਲਤਾਂ ਹੈਗੀਆਂ ਇੱਥੇ ਜਿੰਨਾ ਕੁ ਸਾਡਾ ਸ਼ਹਿਰ ਹੈਗਾ ਲਾਗੇ ਹੀ ਬਾਜ਼ਾਰ ਹੈ ਅਨਾਜ ਮੰਡੀ ਵੀ ਲਾਗੇ ਹੀ ਹੈ ਸਬਜ਼ੀ ਮੰਡੀ ਜਾਣਾ ਸਬਜ਼ੀ ਮੰਡੀ ਵੀ ਲਾਗੇ ਹੀ ਹੈ ਸਾਰਾ ਬਾਜ਼ਾਰ ਲਾਗੇ ਗਾਂਧੀ ਚੌਂਕ ਸਾਡੇ ਲਾਗੇ ਇੱਥੇ ਸਬਜ਼ੀ ਲੱਗ ਮੰਡੀ ਲੱਗਦੀ ਹੈ ਪੂਰੇ ਬਾਜ਼ਾਰ ਦੀ ਦੂਰੋਂ ਦੂਰੋਂ ਮਲਕੀ ਪਿੰਡਾਂ ਵਾਲੇ ਵੀ ਆ ਕੇ ਸਬਜ਼ੀ ਇੱਥੋਂ ਲੈ ਕੇ ਜਾਂਦੇ ਆ ਬਾਜ਼ਾਰ ਬੜਾ ਵਧੀਆ ਸਾਡਾ ਸਬਜ਼ੀ ਮੰਡੀ ਅਨਾਜ ਮੰਡੀ ਹੈ ਕਰਿਆਨੇ ਦੀ ਦੁਕਾਨਾਂ ਇੱਥੇ ਗਲੀ ਗਲੀ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਹੈ ਸਬਜ਼ੀ ਦੀਆਂ ਦੁਕਾਨਾਂ ਬੰਦਾ ਆਰਾਮ ਨਾਲ ਕੋਈ ਵੀ ਚੀਜ਼ ਲੈ ਸਕਦਾ ਸਸਤੇ ਭਾਅ ਦੀਆਂ ਚੀਜ਼ਾਂ ਮਿਲਦੀਆਂ ਨੇ ਹਿਮਾਚਲ ਦਾ ਵੀ ਨਾਲ ਲੱਗਦਾ ਬਾਡਰ ਜੇ ਐਂਡ ਕੇ ਦਾ ਬਾਰਡਰ ਵੀ ਨਾਲ ਲੱਗਦਾ ਜਿਹੜਾ ਵੀ ਆਉਂਦਾ ਇੱਥੋਂ ਸਬਜ਼ੀ ਕੋਈ ਵੀ ਸ਼ੋਪਿੰਗ ਵਗੈਰਾ ਕਰਨੀ ਹੈ ਸਮਾਨ ਲੈਣਾ ਹੋਵੇ ਕਰਿਆਨੇ ਦਾ ਹੋ ਗਿਆ ਜਾਂ ਕੁਛ ਵੀ ਵਿਆਹ ਸ਼ਾਦੀ ਵਾਸਤੇ ਉਹ ਜੋ ਵੀ ਹੈ ਇੱਥੋਂ ਪਠਾਨਕੋਟ ਤੋਂ ਹੀ ਲੈ ਕੇ ਜਾਂਦਾ ਹੈ ਸਪਲਾਈ ਕਰਦਾ ਹਿਮਾਚਲ ਦੀ ਸਪਲਾਈ ਵੀ ਪਠਾਨਕੋਟ ਤੋਂ ਹੀ ਹੁੰਦੀ ਹੈ ਜ਼ਿਆਦਾਤਰ ਜੇ ਐਂਡ ਕੇ ਦੀ ਸਪਲਾਈ ਵੀ ਜ਼ਿਆਦਾਤਰ ਇੱਥੋਂ ਹੀ ਹੈ ਪੰਜਾਬ ਦੀ ਜਿਹੜੀ ਵੀ ਫ਼ਸਲ ਜਿਹੜੀ ਵੀ ਆਉਣੀ ਪਠਾਨਕੋਟ ਤੋਂ ਐਂਟਰ ਹੋ ਕੇ ਹੀ ਅੱਗੇ ਸਪਲਾਈ ਹੁੰਦੀ ਹੈ ਕਰਿਆਨੇ ਦਾ ਸਮਾਨ ਵੀ ਇੱਥੇ ਬਹੁਤ ਸਸਤਾ ਮਿਲਦਾ ਹੈ ਹੋਲਸੇਲਰ ਹੈ ਗਲੀ ਗਲੀ ਦੇ ਵਿੱਚ ਦੁਕਾਨਾਂ ਨੇ ਬਹੁਤ ਹੀ ਜ਼ਿਆਦਾ